ਵੈਸੇ ਤਾਂ ਤਿਉਹਾਰਾਂ ਦੇ ਵਿੱਚ ਮੈਨੂੰ ਬਹੁਤ ਹੀ ਜ਼ਿਆਦਾ ਮੂਰਤੀਆਂ ਬਣਾਉਣ ਦਾ ਸ਼ੌਕ ਹੈ ਜਿਵੇਂ ਕਿ ਹੁਣ ਗੱਲ ਕੀਤੀ ਜਾਵੇ ਥੋੜ੍ਹੇ ਕੁ ਟਾਈਮ ਪਹਿਲਾਂ ਗਣੇਸ਼ ਚਤਰੁਥੀ ਲੰਘੀ ਸੀ ਗਣੇਸ਼ ਚਤੁਰਥੀ ਦੇ ਵਿੱਚ ਮੈਂ ਗਣੇਸ਼ ਭਗਵਾਨ ਦੀ ਮੂਰਤੀ ਬਣਾਈ ਸੀ ਮੈਂ ਥੋੜ੍ਹਾ ਬਹੁਤਾ ਜਿੱਦਾਂ ਗੱਲ ਕੀਤੀ ਛੋਟੀ ਮੂਰਤੀ ਬਣਾਈ ਸੀ ਚਿੱਕੜ ਇਕੱਠਾ ਕਰਕੇ ਉਹਨੂੰ ਇੱਕ ਵਧੀਆ ਅਕਾਰ ਦਿੱਤਾ ਫਿਰ ਉਹਨੂੰ ਐਨ ਚੰਗੀ ਤਰ੍ਹਾਂ ਉਹ ਮੂਰਤੀ ਨੂੰ ਆਕ੍ਰਿਤੀ ਦਿੱਤੀ ਅਤੇ ਉਸ ਮੂਰਤੀ ਨੂੰ ਫਿਰ ਸਜਾ ਕੇ ਉਹਦੀ ਪੂਜਾ ਕੀਤੀ